ਹਾਂਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲੋਕ ਵਿਆਹ 'ਤੇ ਲਾੜੀ ਨੂੰ ਕੀ ਕੀ ਤੋਹਫੇ ਦਿੰਦੇ ਨੇ ਲੋਕ ਕਾਫੀ ਤਰ੍ਹਾਂ ਦੇ ਤੋਹਫੇ ਦੇਣੇ ਪਸੰਦ ਕਰਦੇ ਨੇ ਜਿਵੇਂ ਕਿ ਆਪਾਂ ਕਹਿ ਲਈਏ ਫੋਟੋ ਫਰੇਮ ਕਰੋਕਰੀ ਸੈੱਟ ਕਿਚਨ ਵਿੱਚ ਕਹਿ ਲਓ ਕਰੋਕਰੀ ਸੈੱਟ ਅਤੇ ਕਈ ਜ਼ਿਲ੍ਹਿਆਂ 'ਚ ਦਾਜ ਦਾ ਵੀ ਬਹੁਤ ਪ੍ਰਭਾਵ ਹੈ ਜਿਵੇਂ ਕਿ ਮਾਲਵੇ 'ਚ ਮਾਲਵੇ 'ਚ ਦਾਜ ਵਿੱਚ ਕਹਿ ਲਉ ਘਰ ਦੀ ਹਰੇਕ ਚੀਜ਼ ਜਿਵੇਂ ਸੋਫਾ ਬੈੱਡ ਫਰਿੱਜ ਟੀਵੀ ਅਤੇ ਹੋਰ ਵੀ ਘਰ ਦਾ ਮੇਨ ਜਿਹੜਾ ਸਮਾਨ ਹੈ ਉਹ ਅੱਜ ਵੀ ਦਾਜ ਵਿੱਚ ਦਿੱਤਾ ਜਾਂਦਾ ਹੈ ਅਤੇ ਜੇ ਫੈਮਿਲੀ ਫਰੈਂਡਸ ਵਿੱਚ ਗੱਲ ਕਰੀਏ ਉਹਦੇ ਵਿੱਚ ਮੇਕਅਪ ਸੈੱਟ ਅਤੇ ਸੂਟ ਵਗੈਰਾ ਜਿਹੜੇ ਫੈਮਿਲੀ ਆ ਔਰ ਫਰੈਂਡਸ ਵਿੱਚ ਅੱਜ ਵੀ ਦਿੰਦੇ ਨੇ ਅਤੇ ਹੋਰ ਵੀ ਬਹੁਤ ਸਾਰੇ ਗਿਫਟਸ ਦਿੱਤੇ ਜਾਂਦੇ ਨੇ